ਹਾਂਜੀ ਸਰਕਾਰ ਨੂੰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੈਸਾ ਭੇਜਣਾ ਚਾਹੀਦਾ ਹਨ ਅਤੇ ਪਿੰਡਾਂ ਵਿੱਚ ਗ੍ਰਾਂਟਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਸਪੋਰਟਸ ਬਿਹਤਰ ਹੋ ਸਕੇ